ਕਈ ਸਾਰੇ ਇੱਦਾਂ ਦੇ ਗੀਤ ਹਨ ਜੋ ਕਿ ਮੈਨੂੰ ਬਹੁਤ ਪਸੰਦ ਹਨ ਜੀ ਉਹ ਹਿੰਦੀ ਵੀ ਹਨ ਪੰਜਾਬੀ ਵੀ ਹਨ ਅਤੇ ਅੰਗਰੇਜ਼ੀ ਵੀ ਹਨ ਲੇਕਿਨ ਪੰਜਾਬੀ ਗੀਤ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਹਨ ਅਤੇ ਮੇਰੇ ਮਨ ਨੂੰ ਭਾਉਂਦੇ ਹਨ ਜਿਵੇਂ ਕਿ ਮੇਰਾ ਸਭ ਤੋਂ ਜ਼ਿਆਦਾ ਪਸੰਦੀਦਾ ਗੀਤ ਹੈ ਨਾਨਕ ਜੋ ਕਿ ਅਨਮੋਲ ਗਗਨ ਮਾਨ ਨੇ ਲਿਖਿਆ ਹੈ ਇੱਕ ਹੋਰ ਗੀਤ ਮੈਨੂੰ ਪਸੰਦ ਹੈ ਵਿਸ਼ਵਾਸ ਸਤਿਗੁਰ ਨਾਨਕ ਅਤੇ ਹੋਰ ਵੀ ਕਈ ਸਾਰੇ ਹਨ ਲੇਕਿਨ ਇਹਨਾਂ ਸਭ ਵਿੱਚੋਂ ਨਾਨਕ ਮੇਰਾ ਸਭ ਤੋਂ ਪਸੰਦੀਦਾ ਗੀਤ ਹੈ ਜੋ ਕਿ ਅਨਮੋਲ ਗਗਨ ਮਾਨ ਨੇ ਲਿਖਿਆ ਹੈ ਧੰਨਵਾਦ